ਜੀ ਸਵਾਲ ਦੇ ਵਿੱਚ ਉਲੇਖ ਕੀਤਾ ਗਿਆ ਹੈ ਕੀ ਵੱਖ ਵੱਖ ਹੈ ਜੋ ਕੀ ਧਾਨੂੰ ਦਿਨ ਦੇ ਦੌਰਾਨ ਪਾਣੀ ਦੀ ਲੋੜ ਹੈ ਇਸ ਦਾ ਸਿੱਧਾ ਅਰਥ ਹੈ ਕਿ ਦਿਨ ਦੇ ਵੱਖ ਵੱਖ ਸਮਿਆਂ ਵਿੱਚ ਸਾਨੂੰ ਪਾਣੀ ਦੀ ਲੋੜ ਕਿਉਂ ਪੈਂਦੀ ਹੈ ਅਤੇ ਇਹ ਲੋੜ ਕਿਹੜੇ ਕਾਰਨਾਂ ਨਾਲ਼ ਜੁੜੀ ਹੋਈ ਹੈ ਦਿਨ ਦੇ ਦੌਰਾਨ ਪਾਣੀ ਦੀ ਲੋੜ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਹੈੱਡ ਰੇਸ਼ਮ ਦੀ ਜਰੂਰਤ ਸਾਡਾ ਸ਼ਰੀਰ ਹਰ ਸਮੇਂ ਪਾਣੀ ਦੀ ਲੋੜ ਰੱਖਦਾ ਹੈ ਸ਼ਰੀਰ ਦੇ ਹਰ ਇੱਕ ਹਿੱਸੇ ਨੂੰ ਸਹੀ ਤਰੀਕੇ ਨਾਲ਼ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਜਿਵੇਂ ਕੀ ਖੂਨ ਦਾ ਗਾੜਾ ਹੋਣਾ ਸ਼ਰੀਰ ਦੇ ਤਾਪਮਾਨ ਨੂੰ ਕਾਬੂ ਕਰਨਾ ਅਤੇ ਪਾਚਨ ਪ੍ਰਕਿਰਿਆ ਨੂੰ ਸਹੀ ਰੂਪ ਵਿੱਚ ਚਲਾਣਾ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਸ਼ਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਜੋ ਪਾਚਨ ਪ੍ਰਕਿਰਿਆ ਠੀਕ ਤਰੀਕੇ ਨਾਲ਼ ਹੋ ਸਕੇ ਪਾਣੀ ਦੀ ਘਾਟ ਕਾਰਨ ਖਾਣੇ ਦੇ ਪਚਣ ਵਿੱਚ ਰੁਕਾਵਟ ਆ ਸਕਦੀ ਹੈ ਜਿਵੇਂ ਕੀ ਅਸੀਂ ਉਤ ਸ਼ਰੀਰ ਅਤੇ ਪਸੀਨੇ ਦੁਆਰਾ ਪਾਣੀ ਖੂਦੇ ਹਾਂ ਪਾਣੀ ਨਾਲ਼ ਹੀ ਸ਼ਰੀਰ ਦਾ ਤਾਪਮਾਨ ਕਾਬੂ ਵਿੱਚ ਰਹਿੰਦਾ ਹੈ ਵਿਸ਼ੇਸ਼ ਤੋਰ ਤੇ ਗਰਮੀ ਵਿੱਚ ਅਸ ਜਦੋਂ ਤੁਸੀਂ ਵਿਆਮ ਕਰਦੇ ਹੋ ਤਾਂ ਸ਼ਰੀਰ ਨੂੰ ਪਾਣੀ ਦੀ ਜਰੂਰਤ ਵੱਧ ਜਾਂਦੀ ਹੈ ਖੂਨ ਦੇ ਗਾੜੇਪਨ ਨੂੰ ਵੀ ਇਹ ਘਟਾਉਂਦਾ ਹੈ ਜਿਸ ਨਾਲ਼ ਖੂਨ ਦੀ ਸੁਚਾਰੂ ਸਰਕੂਲੇਸ਼ਨ ਠੀਕ ਹੁੰਦੀ ਹੈ